ਸਾਡੇ ਖੇਤਰ ਦੇ ਵਿੱਚ ਸਿਹਤ ਸੰਭਾਲ ਬਿਹਤਰ ਬਣਾਉਣ ਦੇ ਲਈ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਲਕੁਲ ਸ਼ਹਿਰ ਤੋਂ ਬਾਹਰ ਵੀ ਗਲੀ ਮੁਹ ਹਰ ਗਲੀ ਮੁਹੱਲੇ ਦੇ ਬਾਹਰ ਇੱਕ ਡਿਸਪੈਂਸਰੀ ਖੋਲ੍ਹਣ ਔਰ ਜਿਹਦੇ 'ਚ ਸਸਤੀਆਂ ਦਵਾਈਆਂ ਮਿਲਣ ਲੋਕਾਂ ਨੂੰ ਲੁੱਟਿਆ ਨਾ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਲੋਕ ਨੇ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਖਾਸਕਰ ਹਰੇਕ ਪਿੰਡ ਦੇ ਕਿਸੇ ਨਾ ਕਿਸੇ ਏਰੀਏ ਦੇ ਵਿੱਚ ਵੀ ਡਿਸਪੈਂਸਰੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਤਰਨ ਤਾਰਨ ਸ਼ਹਿਰ ਦੇ ਵਿੱਚ ਹਾਲ ਦੀ ਘੜੀ ਤਾਂ ਹਸਪਤਾਲ ਵੀ ਬਹੁਤ ਘੱਟ ਨੇ ਜਿਹਦੇ ਕਰਕੇ ਜੇ ਰਾਤ ਬਰਾਤ ਕੋਈ ਐਮਰਜੰਸੀ ਪੈ ਜਾਵੇ ਲੋਕਾਂ ਨੂੰ ਅਤੇ ਅੰਮ੍ਰਿਤਸਰ ਦੌੜਨਾ ਪੈਂਦਾ ਜਾਂ ਮਤਲਬ ਜੇ ਇੱਕ ਦੋ ਹੋਸਪਿਟਲ ਹੈ ਨਹੀਂ ਅੱਛੇ ਪਰ ਉਹਨਾਂ 'ਤੇ ਵੀ ਖਰਚਾ ਇੰਨਾ ਹੋ ਜਾਂਦਾ ਕਿ ਲੋਕ ਉਹਨਾਂ 'ਤੇ ਖਰਚਾ ਝੇਲ ਨਹੀਂ ਪਾਉਂਦੇ ਅਤੇ ਜਾਂ ਕਈ ਵਾਰੀ ਉਹਨਾਂ ਹਸਪਤਾਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਪਲਬਧੀਆਂ ਨਹੀਂ ਹੈਗੀਆਂ ਵੀ ਚੀਜ਼ਾਂ ਉਪਲਬਧ ਨਹੀਂ ਨੇ ਜਿਹਦੇ ਕਰਕੇ ਕਿ ਬੜੀ ਦਿੱਕਤ ਆਉਂਦੀ ਹੈ ਲੋਕਾਂ ਨੂੰ ਸੋ ਅਸੀਂ ਚਾਹਵਾਂਗੇ ਕਿ ਲੋਕ ਜਿਹੜੇ ਨੇ ਉਹਨਾਂ ਵਾਸਤੇ ਡਿਸਪੈਂਸਰੀਆਂ ਹਸਪਤਾਲਾਂ ਦੀ ਹਾਲੇ ਹੋਰ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਲੋਕ ਆਪਣੀ ਸਿਹਤ ਵੱਲ ਜਾਗਰੂਕ ਹੋਣ ਔਰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਕੈਂਪ ਲੱਗਣੇ ਚਾਹੀਦੇ ਹਨ ਜਿਨ੍ਹਾਂ 'ਚ ਲੋਕਾਂ ਨੂੰ ਬਿਮਾਰੀਆਂ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਫ੍ਰੀ ਕੈਂਪ ਲੱਗਣੇ ਚਾਹੀਦੇ ਹਨ ਚਾਹੇ ਉਹ ਛੇ ਮਹੀਨੇ ਦੇ ਅੰਤਰਾਲ 'ਤੇ ਲੱਗ ਜਾਣ ਜਾਂ ਸਾਲ 'ਚ ਇੱਕ ਵਾਰੀ ਲੱਗਣ ਪਰ ਐਸਾ ਕੈਂਪ ਲੱਗਣਾ ਜ਼ਰੂਰ ਚਾਹੀਦਾ ਹੈ ਔਰ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਵਾਸਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਫ੍ਰੀ ਇਲਾਜ ਹੋਣਾ ਚਾਹੀਦਾ ਹੈ ਜਿਹੜੇ ਆਰਮੀ ਵਾਲੇ ਹਨ ਜਿਨ੍ਹਾਂ ਦੇ ਦੇਖੋ ਆਰਮੀ ਵਾਲੇ ਸਾਡੇ ਲਈ ਬਹੁਤ ਕੁਛ ਕਰਦੇ ਹਨ ਪਰ ਉਹਨਾਂ ਦੇ ਮਾਂ ਪਿਓ ਦੇ ਲਈ ਸਿਰਫ ਆਰਮੀ ਵਾਲਿਆਂ ਨੂੰ ਇੱਕ ਪਰਟੀਕੁਲਰ ਇੱਕ ਜਗ੍ਹਾ 'ਤੇ ਇੱਕ ਪਾਸ ਬਣਾ ਕੇ ਦਿੱਤਾ ਜਾਂਦਾ ਕਿ ਉੱਥੇ ਉਹ ਕਰਵਾ ਸਕਦੇ ਹਨ ਆਪਣਾ ਇਲਾਜ ਸੋ ਮੈਂ ਚਾਹਵਾਂਗੀ ਕਿ ਆਪਣੇ ਜਿਹੜੇ ਇਨ ਇਹ ਲੋਕ ਨੇ ਜਿਹੜੇ ਸਾਡੇ ਦੇਸ਼ ਦੇ ਲਈ ਬਹੁਤ ਸੇਵਾ ਕਰ ਰਹੇ ਉਹਨਾਂ ਲੋਕਾਂ ਨੂੰ ਕੁਛ ਖਾਸ ਇਹੋ ਜਿਹੀਆਂ ਸਹੂਲਤਾਂ ਹੋਰ ਦਿੱਤੀਆਂ ਜਾ ਸਕਣ ਇਹਨਾਂ ਤੋਂ ਇਲਾਵਾ ਕਈ ਜਗ੍ਹਾ 'ਤੇ ਤਾਂ ਐਸਾ ਹੈ ਕਿ ਡਾਕਟਰ ਵੀ ਨਹੀਂ ਹੈਗੇ ਮਤਲਬ ਜਿਹੜੇ ਚੈਕਅਪ ਕਰ ਸਕਣ ਉਹ ਬਸ ਅਟ ਜਿਹੜੀ ਅੱਟੇ ਸੱਟੇ ਦਵਾਈ ਆਉਂਦੀ ਉਹ ਦੇ ਦਿੱਤੀ ਜਾਂਦੀ ਹੈ ਤਾਂ ਲੋਕਾਂ ਨੂੰ ਇਹ ਜਾਗਰੂਕ ਕਰਨਾ ਚਾਹੀਦਾ ਸਾਨੂੰ ਕਿ ਘਰ ਘਰ ਦੇ ਵਿੱਚ ਫਸਟ ਏਡ ਕਿੱਟ ਵੀ ਹੋਵੇ